ਵੈਸੇ ਤਾਂ ਮੈਂ ਕਈ ਵਾਰ ਬਾਈਕਿੰਗ ਅਨੁਭਵ ਕੀਤੇ ਹਨ ਪਰ ਮੇਰਾ ਸਭ ਤੋਂ ਯਾਦਗਾਰ ਬਾਈਕਿੰਗ ਅਨੁਭਵ ਉਦੋਂ ਸੀ ਜਦੋਂ ਮੈਂ ਆਪਣੇ ਦੋਸਤ ਰਮਨ ਦੇ ਨਾਲ ਬਾਈਕ ਦੇ ਉੱਪਰ ਸ਼ਿਮਲੇ ਗਿਆ ਸੀ ਮੈਂ ਉਹ ਕਦੇ ਨਹੀਂ ਭੁੱਲ ਸਕਦਾ ਸ਼ਿਮਲੇ ਨੂੰ ਜਾਂਦੇ ਜਾਂਦੇ ਆਪਾਂ ਰਸਤੇ ਦੇ ਵਿੱਚ ਬਹੁਤ ਮਸਤੀ ਕਰਦੇ ਗਏ ਆਪਾਂ ਸਾ ਇੱਧਰ ਉੱਧਰ ਜਿੱਧਰ ਵੀ ਦੇਖਦੇ ਸੀ ਬਸ ਪਹਾੜ ਅਤੇ ਖੂਬਸੂਰਤੀ ਸਾਨੂੰ ਓ ਸ਼ਿਮਲੇ ਦੇ ਵਿੱਚ ਬਸ ਇੱਕੇ ਹੀ ਚੀਜ ਦਿਖ ਰਹੀ ਸੀ ਹਰੇਕ ਪਾਸੇ ਆਪਾਂ ਬਸ ਖੂਬਸੂਰਤੀ ਹੀ ਖੂਬਸੂਰਤੀ ਦੇਖਣੇ ਨੂੰ ਮਿਲ ਰਹੀ ਸੀ ਆਪਾਂ ਦੋਨੋਂ ਬਾਈਕ ਦੇ ਉੱਪਰ ਜਾਂਦ ਜਦੋਂ ਜਾ ਰਹੇ ਸੀ ਰਾਸਤੇ ਵਿੱਚ ਹੀ ਸਨੋਅ ਪੈਣ ਲੱਗ ਪਈ ਜਿਹਨੂੰ ਕਿ ਆਪਾਂ ਇੱਕ ਜਗ੍ਹਾ 'ਤੇ ਰੁਕ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਇੰਜੋਆਏ ਕੀਤਾ ਆਪਾਂ ਇੱਕ ਦੂਸਰੇ ਦੇ ਉੱਪਰ ਸਨੋਅ ਨੂੰ ਜਾਂ ਸਨੋਅ ਦੇ ਗੋਲੇ ਬਣਾ ਬਣਾ ਸਿੱਟ ਰਹੇ ਸੀਗੇ ਉਹ ਮੈਨੂੰ ਕਦੇ ਨਹੀਂ ਭੁੱਲਣਾ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਆਪਾਂ ਉੱਥੇ ਸਨੋਅਮੈਨ ਵੀ ਬਣਾਇਆ ਅਤੇ ਆਪਾਂ ਕੁਫ਼ਰੀ ਵੀ ਗਏ ਸੀਗੇ ਘੁੰਮਣ ਆਪਾਂ ਕ੍ਰਿਸਮਸ ਉੱਥੇ ਹੀ ਸੈਲੀਬ੍ਰੇਟ ਕੀਤਾ ਜਿਹਦੇ ਕਰਕੇ ਮੈਨੂੰ ਕਦੇ ਨਹੀਂ ਭੁੱਲ ਸਕਦਾ ਸਾਰੀ ਉਮਰ ਆਪਣੀ